ਮੈਂ ਤਾਂ ਆਪਣੇ ਕੋਲਜ ਲੈਵਲ ਦੀਆਂ ਸਾਰੀਆਂ ਕਿਤਾਬਾਂ ਹਾਲ ਬਜ਼ਾਰ ਤੋਂ ਖਰੀਦੀਆਂ ਕਿਉਂਕਿ ਉੱਥੇ ਹੋਲਸੇਲ ਦੀਆਂ ਦੁਕਾਨਾਂ ਏ ਸਸਤੀਆਂ ਮਿਲ ਜਾਂਦੀਆਂ ਨਾਲ ਮੈਨੂੰ ਬੁੱਕਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਬਜ਼ਾਰੋਂ ਖਰੀਦੋ ਤਾਂ ਬਹੁਤ ਜ਼ਿਆਦਾ ਮਹਿੰਗੀਆਂ ਮਿਲ ਜਾਂਦੀਆਂ ਜਿਹੜੇ ਘਰ ਦੇ ਲਾਗੇ ਮੈਨੂੰ ਤਾਂ ਹੋ ਇੱਥੇ ਹੋਲਸੇਲ ਮਾਰਕੀਟ ਹੈਗੀ ਹਾਲ ਬਜ਼ਾਰ ਆਪਾਂ ਉੱਥੋਂ ਹੀ ਖਰੀਦੀ ਦੀਆਂ ਨਾਲ ਸਸਤੀਆਂ ਮਿਲ ਜਾਂਦੀਆਂ ਨਾਲ ਵਧੀਆ ਸਾਫ ਸੁਥਰੀਆਂ ਮਿਲ ਜਾਂਦੀਆਂ ਕਿਤਾਬਾਂ ਅਤੇ ਜੇ ਇਕੱਠੀਆਂ ਆਪਾਂ ਲਈਏ ਇੱਕ ਦੋ ਜਾਣਿਆਂ ਦੀਆਂ ਹੋਰ ਵੀ ਨਾਲ ਦਿਆਂ ਦੀ ਲੈ ਲਈਏ ਫਿਰ ਹੋਰ ਲੈਸ ਲਗਾ ਦਿੰਦੇ ਹੈ ਅਤੇ ਸੈਕਿੰਡ ਹੈਂਡ ਵੀ ਸਟੋਰ ਹੈਗੀ ਹੈ ਹਾਲ ਬਜ਼ਾਰ ਦੇ ਉਰਾਂ ਆਈਏ ਨੇੜੇ ਆਈਏ ਕਿੰਨੇ ਜ਼ਿਆਦਾ ਹੈਂ ਹੈਂਡ ਉਹ ਸੈਕਿੰਡ ਹੈਂਡ ਹੋਲ ਸਟੇ ਹੋ ਹੋਲ ਸਟੋਰ ਹੈਗੇ ਆ ਉੱਥੋਂ ਵੀ ਮਿਲ ਜਾਂਦੀਆਂ ਹੈਗੀਆਂ ਵਾ ਅਤੇ ਸਾਨੂੰ ਚੰਗੀਆਂ ਕਿਤਾਬਾਂ ਪੜ੍ਹਨੀਆਂ ਵੀ ਚਾਹੀਦੀਆਂ ਵਾ ਅਤੇ ਚੰਗਾ ਲਿਖਣਾ ਵੀ ਚਾਹੀਦਾ ਵਾ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡਾ ਦਿਮਾਗ ਵੀ ਸਹੀ ਰਹਿੰਦਾ ਏ ਠੀਕ ਹੈ ਨਾ ਸਾਡੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਅਤੇ ਸਾਨੂੰ ਚੰਗੀਆਂ ਕਿਤਾਬਾਂ ਖਰੀਦਣੀਆਂ ਵੀ ਚਾਹੀਦੀਆਂ ਵਾ ਹੋਰ ਵੀ ਕਾਫੀ ਥਾਵਾਂ 'ਤੇ ਅੰਮ੍ਰਿਤਸਰ ਵਿੱਚ ਹੋਰ ਵੀ ਮਾਰਕੀਟਾਂ ਹੈਗੀਆਂ ਜਿੱਥੋਂ ਚੰਗੀਆਂ ਬੁੱਕਸ ਮਿਲ ਜਾਂਦੀਆਂ ਵਾ ਸਸਤੀਆਂ ਰੇਟਾਂ 'ਤੇ ਵੀ ਮਿਲ ਜਾਂਦੀਆਂ ਵਾ ਅਤੇ ਹੈਂਡ ਬੁੱਕ ਵਗੈਰਾ ਸਟੋਰ ਵੀ ਕਾਫੀ ਤਰ੍ਹਾਂ ਦੇ ਬਣੇ ਹੋਏ ਹਨ ਜਿੱਥੋਂ ਸਾਨੂੰ ਮਿਲ ਵੀ ਜਾਂਦੇ ਹੈ ਕਈ ਵਾਰੀ ਜਿੱਥੋਂ ਇੱਕ ਦੁਕਾਨ ਤੋਂ ਨਹੀਂ ਮਿਲੇ ਦੂਜੀ ਦੁਕਾਨ 'ਤੇ ਵੀ ਜਾ ਕੇ ਘੁੰਮਣਾ ਫਿਰਨਾ ਵੀ ਪੈਂਦਾ ਪਰ ਮਿਲ ਜ਼ਰੂਰ ਜਾਂਦੇ ਇੱਥੋਂ ਓਕੇ ਜੀ